ਸਿੱਠਣੀਆਂ ਵਿਆਹ ਨਾਲ ਸੰਬੰਧਿਤ ਇੱਕ ਲੋਕ ਕਾਵ ਰੂਪ ਹੈ ਜੀ ਇਹ ਕੁਛ ਔਰਤਾਂ ਦੇ ਗੀਤ ਨੇ ਜਿਹੜੇ ਵਿਆਹ ਸਮੇਂ ਮੇਲਣਾਂ ਜਿਹੜੀਆਂ ਹੈਗੀਆਂ ਨੇ ਉਹ ਸਿੱਠਣੀਆਂ ਦਿੰਦੀਆਂ ਹਨ ਨਵੇਂ ਪ੍ਰਾਹੁਣੇ ਨੂੰ ਅਤੇ ਨੋਕ ਝੋਕ ਕਰਦੀਆਂ ਅਤੇ ਮਖੌਲ ਕਰਦੀਆਂ ਹਨ ਵਿਆਹ ਦੇ ਮੌਕਾ ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਵਧੇਜਾਂ ਦੇ ਸਕੋਝਾਂ ਤੋਂ ਕੁਝ ਖੁੱਲ ਦਿੰਦਾ ਹੈ ਸਿੱਠਣੀਆਂ ਵਿੱਚ ਮੁੰਡੇ ਵਾਲਿਆਂ ਦੇ ਪਹਿਰਾਵੇ ਖਾਣ ਪੀਣ ਦੀਆਂ ਆਦਤਾਂ ਅਤੇ ਉਨ੍ਹਾਂ ਦੇ ਰੰਗ ਬੰਨ ਉੱਤੇ ਟਕੋਰਾਂ ਕੱਸੀਆਂ ਜਾਂਦੀਆਂ ਹਨ